ਅਕਸਰ ਹੀ ਮੈਨੂੰ ਜਿਹੜਾ ਹੈਗਾ ਮਨੋਰੰਜਨ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਪਸੰਦ ਹੈ ਕਿਉਂਕਿ ਪਰਿਵਾਰ ਦੇ ਨਾਲ ਇੱਕ ਵੱਖਰਾ ਜਿਹਾ ਹੀ ਸਕੂਨ ਮਿਲਦਾ ਆ ਹੈ ਨਾ ਕਿਉਂਕਿ ਜਦੋਂ ਆਪਾਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਜਾਂਦੇ ਹਾਂ ਆਪਾਂ ਇੱਕ ਟਾਈਮ ਦਿੰਦੇ ਹਾਂ ਆਪਣੇ ਪਰਿਵਾਰ ਨੂੰ ਜਿਹਦੇ ਨਾਲ ਕਿ ਸਾਡੀ ਪਰਿਵਾਰ ਦੇ ਵਿੱਚ ਹੋਰ ਸਾਂਝ ਵੱਧਦੀ ਆ ਹੈ ਨਾ ਪਿਆਰ ਵੱਧਦਾ ਆ ਉਹਦੇ ਨਾਲ ਕੀ ਹੁੰਦਾ ਸਾਡਾ ਆਪਸੀ ਜਿਹੜੇ ਮਨ ਮਿਟਾਵ ਹੁੰਦੇ ਹਨ ਕਈ ਤਰ੍ਹਾਂ ਦੇ ਉਹ ਵੀ ਦੂਰ ਹੋ ਜਾਂਦੇ ਹਨ ਹੈ ਨਾ ਘਰ ਦੇ ਘਰ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਕਿ ਸਾਨੂੰ ਕਈ ਵਾਰ ਸਮਾਂ ਨਾ ਹੋਣ ਕਰਕੇ ਵੀ ਸਾਨੂੰ ਮਤਲਬ ਜਿਹੜਾ ਹੈਗਾ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਬਸ ਇਹ ਮਨੋਰੰਜਨ ਹੁੰਦਾ ਆ ਘਰ ਪਰਿਵਾਰ ਦੇ ਵਿੱਚ ਜਿਹਦੇ ਵਿੱਚ ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਵੀ ਸਾਡੇ ਆਪਸੀ ਮਨ ਮਿਟਾਵ ਹੁੰਦੇ ਹਨ ਉਹ ਸਭ ਦੂਰ ਹੋ ਜਾਂਦੇ ਹਨ ਦੋਸਤਾਂ ਨਾਲ ਜਿਹੜਾ ਮਨੋਰੰਜਨ ਹੈ ਉਹਦੀ ਇੱਕ ਆਪਣੀ ਜਗ੍ਹਾ ਹੈ ਉਹ ਜਸਟ ਆਪਾਂ ਇੱਕ ਫਨ ਦੇ ਤੌਰ 'ਤੇ ਜਦੋਂ ਆਪਾਂ ਟਾਈਮ ਸਪੈਂਡ ਕਰਨਾ ਚਾਹੁੰਦੇ ਹਾਂ ਅਤੇ ਆਪਾਂ ਉਦੋਂ ਆਪਣੇ ਦੋਸਤਾਂ ਨਾਲ ਪਰ ਸਭ ਤੋਂ ਵੱਧ ਜਿਹੜਾ ਮੈਨੂੰ ਆਪਣੇ ਪਰਿਵਾਰ ਦੇ ਨਾਲ ਹੀ ਮਨੋਰੰਜਨ ਪਸੰਦ ਹੈ ਕਿਉਂਕਿ ਪਰਿਵਾਰ ਦੇ ਵਿੱਚ ਜੋ ਸਕੂਨ ਹੈ ਉਹ ਬਾਹਰ ਕਿਤੇ ਵੀ ਨਹੀਂ ਹੈ ਤੁਸੀਂ ਚਾਹੇ ਸਾਰੀ ਦੁਨੀਆ ਘੁੰਮ ਲਓ ਪਰ ਜੋ ਪਰਿਵਾਰ ਹੈ ਉਹ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਮਾਂ ਪਿਓ ਭੈਣ ਭਰਾ ਇਹ ਸਾਨੂੰ ਦੁਬਾਰਾ ਕਦੀ ਨਹੀਂ ਮਿਲਣੇ ਇਸ ਜ਼ਿੰਦਗੀ ਵਿੱਚ ਇਸ ਕਰਕੇ ਜਿੰਨਾ ਅਸੀਂ ਵੱਧ ਤੋਂ ਵੱਧ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਦੇ ਹਾਂ ਅਤੇ ਓਨਾ ਬਿਤਾਉਣਾ ਚਾਹੀਦਾ ਆ ਅਤੇ ਬਸ